ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਬਹੁਤ ਸਾਰੇ ਲੋਕਾਂ ਨੇ ਯੋਗਦਾਨ ਪਾਇਆ ਹੈ ਜਿਹਨਾਂ ਵਿੱਚੋਂ ਸ਼ਹੀਦ ਭਗਤ ਸਿੰਘ ਸ਼ਹੀਦ ਊਧਮ ਸਿੰਘ ਸ਼ੁਭਾਸ ਚੰਦਰ ਬੋਸ ਮਹਾਤਮਾ ਗਾਂਧੀ ਜੀ ਇਸ ਤਰ੍ਹਾਂ ਇਹਨਾਂ ਸਾਰਿਆਂ ਨੇ ਆਪਣੇ ਆਪਣੇ ਅਸੂਲਾਂ ਅਨੁਸਾਰ ਅੰਦੋਲਨ ਚਲਾਏ ਜਿਹਨਾਂ ਵਿੱਚੋਂ ਮਹਾਤਮਾ ਗਾਂਧੀ ਜੀ ਨੇ ਵੀ ਕਈ ਤਰ੍ਹਾਂ ਦੇ ਅੰਦੋਲਨ ਚਲਾਏ ਜਿਹਨਾਂ ਵਿੱਚੋਂ ਲੂਣ ਸੱਤਿਆਗ੍ਰਹਿ ਅਸਹਿਯੋਗ ਅੰਦੋਲਨ ਸਵਦੇਸ਼ੀ ਅੰਦੋਲਨ ਲੂਣ ਸੱਤਿਆਗ੍ਰਹਿ ਦੇ ਵਿੱਚ ਮਹਾਤਮਾ ਗਾਂਧੀ ਜੀ ਨੇ ਅੰਗਰੇਜ਼ਾਂ ਦੇ ਲੂਣ ਨਾ ਬਣਾਉਣ ਸੰਬੰਧੀ ਬਣਾਏ ਕਾਨੂੰਨ ਦੇ ਵਿਰੁੱਧ ਲੋ ਅੰਦੋਲਨ ਸ਼ੁਰੂ ਕੀਤਾ ਜਿਸ ਵਿੱਚ ਉਹਨਾਂ ਨੇ ਲੋਕਾਂ ਨੂੰ ਨਾਲ ਲੈ ਕੇ ਸਮੁੰਦਰ ਦੇ ਕਿਨਾਰੇ ਜਾ ਕੇ ਆਪਣਾ ਲੂਣ ਆਪ ਤਿਆਰ ਕਰਨ ਲਈ ਲੋਕਾਂ ਨੂੰ ਕਿਹਾ ਅਤੇ ਇਸ ਦਾ ਇਸਤੇਮਾਲ ਕਰਨ ਲਈ ਕਿਹਾ ਆਸਾ ਅਸਹਿਯੋਗ ਅੰਦੋਲਨ ਇਸ ਵਿੱਚ ਮਹਾਤਮਾ ਗਾਂਧੀ ਜੀ ਨੇ ਅੰਗਰੇਜ਼ਾਂ ਨੂੰ ਸਹਿਯੋਗ ਨਾ ਦੇਣ ਸੰਬੰਧੀ ਅੰਦੋਲਨ ਚਲਾਇਆ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਅੰਦ ਆਪਣਾ ਸਹਿਯੋਗ ਅੰਗਰੇਜ਼ਾਂ ਨੂੰ ਨਾ ਦਿੱਤਾ ਜਾ ਰਹੇ ਸਕ ਸਕੇ ਅਤੇ ਇਸ ਅੰਦੋਲਨ ਦੇ ਵਿੱਚ ਹਰ ਇੱਕ ਨੂੰ ਕਿਹਾ ਗਿਆ ਕਿ ਉਹ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਅੰਗਰੇਜ਼ਾਂ ਨੂੰ ਨਾ ਦਿੱਤਾ ਜਾਵੇ ਇਸ ਦੇ ਨਾਲ ਹੀ ਸਵਦੇਸ਼ੀ ਅੰਦੋਲਨ ਵਿੱਚ ਅੰਗਰੇਜ਼ਾਂ ਦੇ ਵਿਰੁੱਧ ਮਹਾਤਮਾ ਗਾਂਧੀ ਜੀ ਨੇ ਕਿਹਾ ਕਿ ਸਿਰਫ ਦੇਸ਼ ਦੀਆਂ ਬਣੀਆਂ ਅਤੇ ਘਰੇਲੂ ਚੀਜ਼ਾਂ ਦੀ ਵਰਤੋਂ ਕੀਤੀ ਜਾਵੇ ਅਤੇ ਉਸ ਨੇ ਅੰਗਰੇਜ਼ਾਂ ਵੱਲੋਂ ਜੋ ਬਾਹਰਲੇ ਦੇਸ਼ਾਂ ਤੋਂ ਕੱਪੜੇ ਲਿਆਂਦੇ ਗਏ ਸੀ ਇੰਗਲੈਂਡ 'ਚੋਂ ਉਹਨਾਂ ਨੂੰ ਜ ਜਲਾ ਕੇ ਇਸ ਅੰਦੋਲਨ ਦਾ ਸ਼ੁਰੂਆਤ ਕੀਤੀ ਇਸ ਵਿੱਚ ਹੀ ਉਹਨਾਂ ਨੇ ਚਰਖਾ ਚਲਾਉਣਾ ਵੀ ਦੱਸਿਆ ਕਿ ਆਪਣਾ ਕੱਪੜੇ ਆਪ ਤੁਸੀਂ ਤਿਆਰ ਕਰੋ ਕੋਈ ਵੀ ਚੀਜ਼ ਆ ਦੇਸ਼ ਵਿੱਚ ਆਪਣੀ ਆਪ ਤਿਆਰ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਦੇ ਹੋਰ ਵੀ ਕਈ ਅੰਦੋਲਨ ਜਿਹੜੇ ਹੈਗੇ ਮਹਾਤਮਾ ਗਾਂਧੀ ਜੀ ਵੱਲੋਂ ਚਲਾਏ ਗਏ ਆ ਅਤੇ ਦੇਸ਼ ਵਿੱਚ ਆਜ਼ਾਦ ਕਰਵਾਉਣ ਲਈ ਵੀ ਉਸ ਉਹਨਾਂ ਨੇ ਨਾਮਿਲਵਰਤਨ ਅੰਦੋਲਨ ਵਿੱਚ ਚਲਾਇਆ ਇਸ ਤਰ੍ਹਾਂ ਇਹ ਵੀ ਅੰਦੋਲਨ ਸੀਗੇ ਜੋ ਹੋਰ ਵੀ ਕਈ ਤਰ੍ਹਾਂ ਦੇ ਅੰਦੋਲਨ ਸ਼ੁਰੂ ਕੀਤੇ